ਦੁਰਲੱਭ ਪੰਛੀ ਪੰਜਾਬ ਦਾ ਇਲ੍ਹ ਹੈ ਜੋ ਕਿ ਬਹੁਤ ਵਧੀਆ ਪੰਛੀ ਗਿਣਿਆ ਜਾਂਦਾ ਸੀ ਇਸ ਦਾ ਮਨੁੱਖੀ ਸਰੀਰ 'ਤੇ ਜਾਂ ਹੋਰ ਕਿਸੇ ਨੂੰ ਕੋਈ ਇਹ ਨੁਕਸਾਨ ਨਹੀਂ ਸੀ ਪਹੁਚਾਉਂਦੇ ਜਦੋਂ ਸਾਡੇ ਪਸ਼ੂ ਮਰ ਜਾਂਦੇ ਸੀ ਅਸੀਂ ਉਹਨਾਂ ਨੂੰ ਇੱਕ ਅਲੱਗ ਜਗ੍ਹਾ 'ਤੇ ਛੱਡ ਆਉਂਦੇ ਹਾਂ ਅਤੇ ਇਹ ਇਲ੍ਹ ਪੰਛੀ ਹੀ ਦੁਰਲੱਭ ਪੰਛੀ ਸੀ ਜਿਹੜਾ ਇਸ ਨੂੰ ਆ ਕੇ ਖਾ ਕੇ ਅਤੇ ਉਹਨਾਂ ਨੂੰ ਬਿਮਾਰੀ ਫੈਲਣ ਤੋਂ ਰੋਕਦਾ ਹੁੰਦਾ ਸੀ ਅਤੇ ਇਸ ਨੇ ਉਹ ਉਸਦਾ ਮਾਸ ਖਾ ਕੇ ਅਤੇ ਮਨੁੱਖਤਾ ਸਰੀਰ ਨੂੰ ਕੋਈ ਇਹ ਨੁਕਸਾਨ ਨਹੀਂ ਸੀ ਪਹੁਚਾਉਂਦਾ ਇਹ ਅਸਮਾਨ ਦੇ ਵਿੱਚ ਸਾਰਾ ਸਾਰਾ ਦਿਨ ਉੱਡਦਾ ਰਹਿੰਦਾ ਸੀ ਅਤੇ ਜਿਸ ਨਾਲ ਕਿਸੇ ਵੀ ਕਿਸਮ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਸੀ ਪਹੁੰਚਾਉਂਦਾ ਹੁਣ ਫ਼ੋਨ ਦੀਆਂ ਜ਼ਿਆਦਾ ਕਿਰਨਾਂ ਹੋਣ ਕਾਰਨ ਅਤੇ ਕੁਝ ਸੁਣਨ ਵਿੱਚ ਆਉਂਦਾ ਕਿ ਵਿਦੇਸ਼ਾਂ ਦੇ ਲੋਕ ਵੀ ਇਹਨਾਂ ਨੂੰ ਫੜ ਕੇ ਲੈ ਗਏ ਹਨ ਜੋ ਕਿ ਹੁਣ ਪਛਾ ਪੰਜਾਬ ਵਿੱਚੋਂ ਇਹ ਦੁਰਲੱਭੀ ਪੰਛੀ ਹੋ ਗਿਆ ਹੈ ਇੱਥੋਂ ਦਾ ਅਤੇ ਹੁਣ ਇਸ ਦਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਪੰਜਾਬ ਨੂੰ ਜੋ ਨਾ ਪੈਣ ਵਾਲਾ ਘਾਟਾ ਹੈ ਇਸ ਪੰਛੀ ਨਾਲ ਪੈ ਰਿਹਾ ਹੈ